ਭੰਗੜਾ ਐਰੋਬਿਕਸ ਜਿਹੜਾ ਹੈ ਉਹਦੇ ਵਿੱਚ ਹਿੱਸਾ ਲੈਣ ਨਾਲ ਮੈਨੂੰ ਬਹੁਤ ਮਜ਼ਾ ਆਉਂਦਾ ਕਿਉਂਕਿ ਮੈਂ ਅੱਜ ਕੱਲ ਦੀ ਜਿੱਦਾਂ ਦੀ ਸਮਾਜ ਹ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਤੇ ਬਹੁਤ ਜਿਆਦਾ ਮਾਨਸਿਕ ਤਣਾਓ ਆ ਸ਼ਰੀਰਕ ਤਨਾਓ ਹੈ ਸਾਡੇ ਕੋਲ ਬੈਠਣ ਦਾ ਇਨਾ ਟਾਈਮ ਨਹੀਂ ਸਾਨੂੰ ਕੁਝ ਕਰਨ ਦਾ ਸਾਡੇ ਕੋਲ ਇਨਾ ਟਾਈਮ ਨਹੀਂ ਹੈ ਸਾਡੇ ਕੋਲ ਕੁਛ ਵੀ ਕਰਨ ਦਾ ਸਮਾਂ ਨਹੀਂ ਹੈ ਮਤਲਬ ਕਿ ਅਸੀਂ ਜੋ ਕੋਈ ਵੀ ਸਰੀਰਕ ਕਸਰਤ ਕਰ ਲਈਏ ਇਹ ਸਾਡੇ ਕੋਲ ਇਨਾ ਅਗਰ ਸਮਾਂ ਨਹੀਂ ਹੈ ਤੇ ਅਸੀਂ ਭੱਜ ਦੌੜ ਦੀ ਦੁਨੀਆਂ ਅੱਜਕਲ ਜਲਦੀ ਪਈ ਐ ਤੇ ਜਿਹੜੇ ਲੋਕ ਦੇ ਬੁਝੇ ਬੁਝੇ ਰਹਿੰਦੇ ਜਿਹੜੇ ਕਿ ਥੱਕ ਜਾਂਦੇ ਨੇ ਥੱਕ ਟੁੱਟ ਕੇ ਆਉਂਦੇ ਨੇ ਕੰਮਕਾਜ ਤੋਂ ਤੇ ਉਹ ਆਪਣੇ ਆਪ ਨੂੰ ਬਹੁਤ ਹੀ ਜਿਆਦਾ ਮਾਨਸਿਕ ਤੌਰ ਤੇ ਬਹੁਤ ਜਿਆਦਾ ਥਕਾਵਟ ਮਹਿਸੂਸ ਕਰਦੇ ਨੇ ਉਹਨਾਂ ਵਾਸਤੇ ਬਹੁਤ ਹੀ ਵਧੀਆ ਚੀਜ਼ ਹ ਤੇ ਮੈਨੂੰ ਤੇ ਉਦਾਂ ਹੀ ਬਹੁਤ ਪਸੰਦ ਹ ਇਹ ਭੰਗੜਾ ਤੇ ਐਰੋਬਿਕਸ ਤੇਜ਼ੀ ਨਾਲ ਬਹੁਤ ਤੇਜੀ ਗਤੀ ਨਾਲ ਕੀਤਾ ਜਾਂਦਾ ਭੰਗੜਾ ਐਰੋਬਿਕਸ ਭੰਗੜਾ ਜਿਹੜਾ ਉਹ ਸਮਾਂ ਸਾਡੇ ਪੰਜਾਬ ਦਾ ਹੀ ਲੋਕ ਪ੍ਰੀਆ ਨਾਚ ਹੈ ਤੇ ਇਹਦੇ ਵਿੱਚ ਅਰੋਬਿਕ ਜਿਹੜਾ ਹੈ ਜੁੜ ਗਿਆ ਇਹਦੇ ਨਾਲ ਹੋਰ ਤੇਜ਼ ਕਰ ਦਿੰਦਾ ਭੰਗੜੇ ਨੂੰ ਤੇ ਸਾਨੂੰ ਤੇ ਬਹੁਤ ਹੀ ਮਜ਼ਾ ਆਉਂਦਾ ਭੰਗੜਾ ਪਾ ਕੇ ਤੇ ਅਸੀਂ ਵੀ ਜਦੋਂ ਵੀ ਯਾਰ ਦੋਸਤ ਇਕੱਠੇ ਹੁੰਦੇ ਆ ਸਹੇਲੀਆਂ ਆਉਂਦੀਆਂ ਸਾਡੇ ਰਿਸ਼ਤੇਦਾਰ ਆਉਂਦੇ ਨੇ ਤੇ ਅਸੀਂ ਤਾਂ ਉਦਾਂ ਵੀ ਭੰਗੜਾ ਕਰਦੇ ਆ ਵਿਆਹ ਦੇ ਵਿਆਹਾਵਾਂ ਵਿੱਚ ਪੰਜਾਬੀਆਂ ਦੇ ਬਹੁਤ ਜਿਆਦਾ ਭੰਗੜਾ ਕੀਤਾ ਜਾਂਦਾ ਤੇ ਇੱਕ ਬਹੁਤ ਜਿਆਦਾ ਖੁਸ਼ੀ ਮਿਲਦੀ ਹ ਭੰਗੜਾ ਕਰਕੇ ਤੇ ਤਰੋ ਤਾਜ਼ਾ ਹੋ ਜਾਂਦੇ ਆ ਭੰਗਲਾ ਕਰਕੇ ਅਸੀਂ ਇਸ ਨਾਲ ਜਿਹੜਾ ਮਾਨਸਿਕ ਜਿਹੜਾ ਸੰਤੁਸ਼ਟੀ ਵੀ ਮਿਲਦੀ ਹੈ ਤੇ ਸਾਡਾ ਦਿਮਾਗ ਵੀ ਸ਼ਾਂਤ ਹੋ ਜਾਂਦਾ ਤੇ ਬਹੁਤ ਤੇਜ਼ੀ ਨਾਲ ਚੱਲਦਾ ਹੈ ਧੰਨਵਾਦ